ਪੰਜਾਬੀ ਭਾਸ਼ਾ ਦੀ ਵਰਤੋਂ ਸਥਾਨਿਕ ਅਤੇ ਆਰਥਿਕ ਤੌਰ 'ਤੇ ਕੀਤੀ ਜਾਂਦੀ ਹੈ ਜਿਸ ਪ੍ਰਕਾਰ ਸਾਡੇ ਪੰਜਾਬ ਦੇ ਰਾਜ ਅਲੱਗ ਅਲੱਗ ਉਹਨਾਂ ਦੀਆਂ ਬੋਲੀਆਂ ਵੀ ਵੱਖਰੀਆਂ ਹਨ ਜਿਵੇਂ ਕਿ ਮਾਲਵੇ ਵਾਲੇ ਮਲਵਈ ਬੋਲਦੇ ਹਨ ਦੁਆਬੇ ਵਾਲੇ ਦੁਆਬੀ ਬੋਲਦੇ ਹਨ ਮਾਝੇ ਵਾਲੇ ਮਾਝੀ ਬੋਲਦੇ ਹਨ ਕੁਝ ਸ਼ਬਦ ਸਾਡੇ ਬਹੁਤ ਅਲੱਗ ਹਨ ਬੋਲਣ ਵਿੱਚ ਸਰਕਾਰੀ ਕੰਮਾਂ ਵਿੱਚ ਟਕਸਾਲੀ ਪੰਜਾਬੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਟੀ ਵੀ ਵਿੱਚ ਪੰਜਾਬੀ ਚੈਨਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਅਖਬਾਰ ਰਾਹੀਂ ਸਾਡੇ ਤੱਕ ਪੰਜਾਬੀ ਵਿੱਚ ਬਹੁਤ ਜਾਣਕਾਰੀਆਂ ਪਹੁੰਚਦੀਆਂ ਹਨ ਪੰਜਾਬੀ ਭਾਸ਼ਾ ਬਹੁਤ ਥਾਵਾਂ 'ਤੇ ਵਰਤੀ ਜਾਂਦੀ ਹੈ ਜਿਵੇਂ ਕਿ ਖਬਰਾਂ ਰੇਡੀਓ ਚੈਨਲ ਹਨ ਉਹਨਾਂ ਵਿੱਚ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਬਹੁਤ ਤਰੀਕਿਆਂ ਨਾਲ ਵਰਤੀ ਜਾਂਦੀ ਹੈ ਆਪੋ ਆਪਣੇ ਸਾਰਿਆਂ ਦਾ ਅਲੱਗ ਅਲੱਗ ਨਜ਼ਰੀਆ ਹੈ ਪੰਜਾਬੀ ਬੋਲਣ ਦਾ ਟੀ ਵੀ ਵਿੱਚ ਪੰਜਾਬੀ ਚੈਨਲਾਂ ਵਿੱਚ ਕਾਫੀ ਅਲੱਗ ਅਲੱਗ ਤੀ ਤਰੀਕੇ ਨਾਲ ਪੰਜਾਬੀ ਬੋਲਦੇ ਹਨ ਖਬਰਾਂ ਪੰਜਾਬੀ ਖਬਰਾਂ ਰਾਹੀਂ ਵੀ ਸਾਡੇ ਤੱਕ ਅਖਬਾਰਾਂ ਰਾਹੀਂ ਵੀ ਪੰਜਾਬੀ 'ਚ ਸਾਡੇ ਵਾ ਤੱਕ ਬਹੁਤ ਜਾਣਕਾਰੀਆਂ ਪਹੁੰਚਦੀਆਂ ਹਨ